ਜਿਹੜਾ ਹਸਪਤਾਲਾਂ ਦਾ ਪ੍ਰਬੰਧਨ ਹੈ ਉਹ ਜਿਹੜਾ ਇੰਨਾ ਵਧੀਆ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਕਿ ਇੰਨਾ ਪ੍ਰਬੰਧ ਵਧੀਆ ਨਹੀਂ ਹੈਗਾ ਇੱਥੇ ਨਾ ਤਾਂ ਡੋਕਟਰ ਇੰਨੇ ਵਧੀਆ ਹੈਗੇ ਹੈ ਨਾ ਅਤੇ ਨਾ ਹੀ ਇੰਨੀਆਂ ਸਹੂਲਤਾਂ ਇੰਨੀਆਂ ਵਧੀਆ ਹੈਗੀਆਂ ਹਨ ਅਤੇ ਇਹਦੇ ਵਿੱਚ ਜਿਹੜੇ ਕਿ ਜਿਹੜੇ ਦਾਖਲਾ ਅਤੇ ਇਲਾਜ ਆ ਨਾ ਉਹ ਵੀ ਇੰਨਾ ਵਧੀਆ ਨਹੀਂ ਹੈਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮਰੀਜ਼ ਨੂੰ ਆਪਾਂ ਵੀ ਐਡਮਿਟ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਫੀਸ ਭਾਲਦੇ ਐ ਡੋਕਟਰ ਮਤਲਬ ਐਡਮਿਟ ਫੀਸ ਲੈਂਦੇ ਸਨ ਬੈੱਡ ਦੀ ਫੀਸ ਲੈਂਦੇ ਸਨ ਇੱਥੋਂ ਤੱਕ ਕਿ ਖੜ੍ਹਨ ਦੀ ਫੀਸ ਵੀ ਲੈਂਦੇ ਸਨ ਅਤੇ ਇੱਥੇ ਜਿਹੜਾ ਇਲਾਜ ਆ ਉਹ ਵੀ ਇੰਨਾ ਵਧੀਆ ਨਹੀਂ ਹੁੰਦਾ ਜਿਹੜੇ ਡੋਕਟਰ ਹੁੰਦੇ ਹਨ ਉਹ ਵੀ ਮਤਲਬ ਇਲਾਜ ਕਰਨ ਤੋਂ ਪਹਿਲਾਂ ਫੀਸ ਭਾਲਦੇ ਸਨ ਵੱਧ ਤੋਂ ਵੱਧ ਪੈਸੇ ਪੈਸੇ ਨੂੰ ਅਹਿਮੀਅਤ ਦਿੰਦੇ ਹਨ ਡੋਕਟਰ ਜਿਹੜੇ ਹੁੰਦੇ ਆ ਮਰੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਹਨ ਮਰੀਜ਼ ਦਾ ਇਲਾਜ ਛੇਤੀ ਨਹੀਂ ਕਰਦੇ ਹਨ ਅਤੇ ਜਿਹੜੀ ਇਹਦੀ ਪ੍ਰਕਿਰਿਆ ਦਾ ਵਿਘਟਨ ਹੈ ਮਤਲਬ ਕਿ ਇਹਦੇ ਵਿੱਚ ਜਿਹੜੇ ਸਰਕਾਰ ਨੂੰ ਆ ਕੇ ਸਭ ਤੋਂ ਪਹਿਲਾਂ ਮਰੀਜ਼ ਦੇ ਵਾਸਤੇ ਬਹੁਤ ਵਧੀਆ ਕਾਨੂੰਨ ਬਣਾਉਣੇ ਚਾਹੀਦੇ ਸਨ ਕਿ ਜਿਹੜੇ ਡੋਕਟਰ ਆ ਉਹਦੇ ਵਾਸਤੇ ਕੁਛ ਕਾਨੂੰਨ ਲਾਗੂ ਕਰਨੇ ਚਾਹੀਦੇ ਸਨ ਕਿ ਜਿਹੜੇ ਵੀ ਪੈਸੇ ਨੂੰ ਅਹਿਮੀਅਤ ਨਾ ਦੇਣ ਮਰੀਜ਼ ਨੂੰ ਅਹਿਮੀਅਤ ਦੇਣ ਜਿਹਦੇ ਨਾਲ ਕਿ ਇਹ ਮਰੀਜ਼ ਜਿਹੜਾ ਇੱਕ ਮਰੀਜ਼ ਦਾ ਇਲਾਜ ਕਰ ਸਕਣ ਅਤੇ ਪੈਸਿਆਂ ਦਾ ਨਾ ਜਦੋਂ ਵੀ ਉਹ ਜਿਹੜੇ ਪੈਸੇ ਆ ਗਏ ਉਹ ਘਟਾ ਸਕਣ ਅਤੇ ਵੀ ਜਿਹੜੇ ਮਤਲਬ ਸਰਕਾਰ ਨੂੰ ਵਧੀਆ ਤੋਂ ਵਧੀਆ ਹਸਪਤਾਲ ਖੋਲ੍ਹਣੇ ਚਾਹੀਦੇ ਹਨ ਗਰੀਬਾਂ ਵਾਸਤੇ ਅਤੇ ਅਮੀਰਾਂ ਵਾਸਤੇ ਜਿਹੜੀ ਵੀ ਗਰੀਬ ਜਿਹੜਾ ਆਪਣਾ ਇਲਾਜ ਕਰਾ ਸਕੇ ਅਤੇ ਗਰੀਬ ਮਤਲਬ ਆਪਣੇ ਮਤਲਬ ਆਪਣੀ ਸਿਹਤ ਦਾ ਧਿਆਨ ਰੱਖ ਸਕੇ ਅਤੇ ਸਭ ਤੋਂ ਵਧੀਆ ਇਹ ਜਿਹੜੇ ਹਸਪਤਾਲਾਂ ਦੇ ਵਿੱਚ ਜਿਹੜਾ ਸਟਾਫ ਦੇ ਮੈਂਬਰ ਹੈਗੇ ਸਟਾਫ ਵਧੀਆ ਹੋਣਾ ਚਾਹੀਦਾ ਕਿ ਹਰ ਇੱਕ ਨੂੰ ਪਿਆਰ ਨਾਲ ਬੋਲੇ ਹਰ ਇੱਕ ਦੇ ਮਤਲਬ ਰਿਸਪੈਕਟ ਕਰੇ ਅਤੇ ਹਰ ਇੱਕ ਨੂੰ ਵਧੀਆ ਰੱਖੇ ਇਸ ਕਰਕੇ ਜਿਹੜੇ ਇਹਦੇ ਇਹਦੇ ਵਿੱਚ ਕੁਛ ਕਾਨੂੰਨ ਲਾਗੂ ਹੋਣੇ ਚਾਹੀਦੇ ਜਿਹਦੇ ਨਾਲ ਸਾਡੀ ਜਿਹੜੀ ਦੇਸ਼ ਦੀ ਸਿਹਤ ਪ੍ਰਣਾਲੀ ਇਹ ਸਭ ਤੋਂ ਵਧੀਆ ਹੋਵੇਗੀ